ਮੈਂ ਛੋਟੇ ਹੁੰਦੇ ਤੋਂ ਹੀ ਖਾਣਾ ਬਣਾਉਂਦੀ ਹਾਂ ਅਤੇ ਮੈਨੂੰ ਖਾਣਾ ਖਾਣਾ ਬਣਾਉਣਾ ਬਹੁਤ ਵਧੀਆ ਲੱਗਦਾ ਆ ਅਤੇ ਮੈਂ ਖਾਣਾ ਬਣਾਉਂਦੇ ਸਮੇਂ ਖਾਣਾ ਬਣਾਉਂਦੇ ਸਮੇਂ ਇਹ ਸਾਵਧਾਨੀਆਂ ਵਰਤਦੀ ਹਾਂ ਕਿ ਕਿਤੇ ਸਬਜ਼ੀ ਕੱਟਣ ਟਾਈਮ ਮੇਰੇ ਹੱਥ ਵਿੱਚ ਕੋਈ ਚਾਕੂ ਨਾ ਲੱਗ ਜਾਵੇ ਅਤੇ ਮੈਂ ਸਬਜ਼ੀਆਂ ਨੂੰ ਕੱਟਦੇ ਟਾਈਮ ਇਹ ਧਿਆਨ ਰੱਖਦੀ ਹਾਂ ਕਿ ਸਬਜ਼ੀਆਂ ਵਿੱਚ ਕੋਈ ਕੀੜਾ ਵਗੈਰਾ ਨਾ ਹੋਵੇ ਅਤੇ ਇਹ ਇਹ ਉਸ ਤੋਂ ਬਾਅਦ ਮੈਂ ਇਹ ਵੀ ਧਿਆਨ ਰੱਖਦੀ ਹਾਂ ਕਿ ਸ ਕਿਤੇ ਗੈਸ ਵਗੈਰਾ ਲਿੰਕ ਲੀਕ ਵਗੈਰਾ ਨਾ ਹੁੰਦਾ ਹੋਵੇ ਅਤੇ ਮੈਂ ਬਾਰ ਬਾਰ ਹੱਥ ਵਗੈਰਾ ਧੋਂਦੀ ਰਹਿੰਦੀ ਹਾਂ ਕਿਉਂਕਿ ਸ ਅੱਜ ਕੱਲ੍ਹ ਸਫਾਈ ਬਹੁਤ ਜ਼ਰੂਰੀ ਆ ਅਤੇ ਮੈਨ ਸਬਜ਼ੀ ਬਣਾ ਸਬਜ਼ੀ ਧੋਂਦੇ ਟਾਈਮ ਵੀ ਇਹ ਧਿਆਨ ਰੱਖਣਾ ਇਹ ਧਿਆਨ ਰੱਖਦੀ ਹਾਂ ਕਿ ਸਬਜ਼ੀ ਵਿੱਚ ਕੋਈ ਮਿੱਟੀ ਵਗੈਰਾ ਜਾਂ ਕੁਛ ਹੋਰ ਨਾ ਹੋਵੇ